ਭਾਸ਼ਾ ਇੱਕ ਅਜਿਹਾ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰ ਦੂਜੇ ਮਨੁੱਖਾਂ ਨਾਲ ਸਾਂਝਾ ਕਰ ਸਕਦਾ ਹੈ ਭਾਸ਼ਾ ਇੱਕ ਅਜਿਹੀ ਸ਼ਕਤੀ ਹੈ ਜੇਕਰ ਇਹ ਨਾ ਹੁੰਦੀ ਤਾਂ ਸ਼ਾਇਦ ਵਿਅਕਤੀ ਦੇ ਮਨ ਦੀਆਂ ਭਾਵਨਾਵਾਂ ਉਸ ਦੇ ਅੰਦਰ ਹੀ ਰਹਿ ਜਾਂਦੀਆਂ ਜਿੱਥੋਂ ਤੱਕ ਪੰਜਾਬੀ ਨੂੰ ਸਿੱਖਣ ਦਾ ਸਵਾਲ ਹੈ ਤਾਂ ਪੰਜਾਬੀ ਮੇਰੀ ਮਾਂ ਬੋਲੀ ਹੈ ਅਤੇ ਮਾਂ ਬੋਲੀ ਨੂੰ ਵਿਅਕਤੀ ਨੂੰ ਕਿਤੋਂ ਸਿੱਖਣ ਦੀ ਜ਼ਰੂਰਤ ਨਹੀਂ ਪੈਂਦੀ ਕੋਈ ਵਿਸ਼ੇਸ਼ ਟਰੇਨਿੰਗਾਂ ਨਹੀਂ ਲੈਣੀਆਂ ਪੈਂਦੀਆਂ ਮਾਂ ਬੋਲੀ ਹੈ ਤਾਂ ਇਹ ਮਾਂ ਤੋਂ ਪ੍ਰਾਪਤ ਹੋਈ ਹੈ ਬੱਚਾ ਜਦੋਂ ਆਪਣੇ ਮੈਂ ਦੇ ਪੇਟ ਵਿੱਚ ਹੁੰਦਾ ਹੈ ਉਦੋਂ ਤੋਂ ਹੀ ਉਹ ਆਪਣੀ ਮਾਂ ਬੋਲੀ ਨੂੰ ਸਿੱਖਣਾ ਸ਼ੁਰੂ ਕਰ ਦਿੰਦਾ ਹੈ ਤਾਂ ਇਸ ਤੋਂ ਬਾਅਦ ਜਿਵੇਂ ਜਿਵੇਂ ਮੇਰਾ ਬਚਪਨ ਸ਼ੁਰੂ ਹੋਇਆ ਮੈਂ ਵੱਡੀ ਹੁੰਦੀ ਗਈ ਤਾਂ ਮੇਰੇ ਘਰ ਵਿੱਚ ਮੇਰੇ ਪਰਿਵਾਰ ਵਿੱਚ ਮੇਰੇ ਆਸ ਪਾਸ ਦੇ ਮਾਹੌਲ ਵਿੱਚ ਪੰਜਾਬੀ ਭਾਸ਼ਾ ਬੋਲੀ ਜਾਂਦੀ ਸੀ ਤਾਂ ਉਸ ਮਾਹੌਲ ਵਿੱਚ ਰਹਿ ਕੇ ਪੰਜਾਬੀ ਨੂੰ ਮੈਂ ਅਪਣਾਇਆ ਅਤੇ ਇਸ ਤੋਂ ਬਾਅਦ ਜਿਵੇਂ ਮੈਂ ਸਕੂਲ ਦੇ ਵਿੱਚ ਲੱਗੀ ਤਾਂ ਸਕੂਲ ਦੇ ਵਿੱਚ ਮੇਰਾ ਮਾ ਮਾਧਿਅਮ ਕਦੇ ਅੰਗਰੇਜ਼ੀ ਨਹੀਂ ਰਿਹਾ ਬਲਕਿ ਮੈਂ ਆਪਣੀ ਸਾਰੀ ਪੜ੍ਹਾਈ ਹੀ ਪੰਜਾਬੀ ਮਾਧਿਅਮ ਵਿੱਚ ਕੀਤੀ ਹੈ ਅਤੇ ਇਸ ਦੇ ਨਾਲ ਨਾਲ ਮੈਂ ਥੋੜ੍ਹੀ ਬਹੁਤ ਪੰਜਾਬੀ ਵਿੱਚ ਕਵਿਤਾਵਾਂ ਵਗੈਰਾ ਵੀ ਲਿਖ ਲੈਂਦੀ ਹਾਂ ਅਤੇ ਪੰਜਾਬੀ ਨਾਲ ਮੇਰਾ ਅਨੁਭਵ ਬਹੁਤ ਵਧੀਆ ਹੈ ਕਿਉਂਕਿ ਚਾਹੇ ਅਸੀਂ ਹੋਰ ਕੋਈ ਵੀ ਭਾਸ਼ਾ ਬੋਲਦੇ ਹਾਂ ਅੰਗਰੇਜ਼ੀ ਲਗਾ ਲਓ ਜਾਂ ਕੋਈ ਵੀ ਪਰ ਜਦੋਂ ਵਿਅਕਤੀ ਆਪਣੀ ਮਨ ਦੀ ਗੱਲ ਕਰਨ ਦੀ ਕਿਸੇ ਨਾਲ ਗੱਲ ਕਰਦਾ ਹੈ ਤਾਂ ਉਹ ਆਪਣੀ ਮਾਂ ਬੋਲੀ ਵਿੱਚ ਹੀ ਕੀਤੀ ਜਾ ਸਕਦੀ ਹੈ ਅਤੇ ਜਿਹੜਾ ਸਕੂਨ ਵਿਅਕਤੀ ਨੂੰ ਇੱਕ ਉਸ ਦੀ ਮਾਂ ਭਾਸ਼ਾ ਮਾਂ ਬੋਲੀ ਵਿੱਚ ਮਿਲ ਸਕਦਾ ਹੈ ਉਹ ਹੋਰਨਾਂ ਭਾਸ਼ਾਵਾਂ ਵਿੱਚ ਕਦੇ ਵੀ ਪ੍ਰਾਪਤ ਨਹੀਂ ਹੋ ਸਕਦਾ ਅਤੇ ਮਾਂ ਬੋਲੀ ਹਰੇਕ ਵਿਅਕਤੀ ਲਈ ਹਮੇਸ਼ਾ ਹੀ ਇੱਕ ਅਰਾਮਦਾਇਕ ਭਾਸ਼ਾ ਹੁੰਦੀ ਹੈ